ਵੱਖ ਵੱਖ ਪਕਵਾਨਾਂ ਨੂੰ ਆਪਾਂ ਪਕਾਉਣ ਦਾ ਜਿਹੜਾ ਢੰਗ ਹਰ ਇੱਕ ਦਾ ਵੱਖਰਾ ਹੁੰਦਾ ਹੈ ਕੋਈ ਜਿਹੜੀ ਸਬਜ਼ੀ ਹੈ ਉਹ ਪਾਣੀ ਵਿੱਚ ਰਿੱਝਦੀ ਹੈ ਕੋਈ ਨਹੀਂ ਵੀ ਰਿੱਝਦੀ ਕੋਈ ਇੱਦਾਂ ਵੀ ਪੱਕ ਜਾਂਦੀ ਹੈ ਜਿਹਨੂੰ ਆਪਾਂ ਅਗਰ ਸਲੋਅ ਗੈਸ 'ਤੇ ਪਕਾਉਣ ਦੀ ਕੋਸ਼ਿਸ਼ ਕਰਦੇ ਆਂ ਬਿਨਾਂ ਪਾਣੀ ਤੋਂ ਜਦੋਂ ਆਪਾਂ ਪਾਣੀ ਨਹੀਂ ਪਾਉਣਾ ਹੁੰਦਾ ਆਪਾਂ ਘਿਓ ਥੋੜ੍ਹਾ ਜਿਹਾ ਜ਼ਿਆਦਾ ਪਾ ਕੇ ਉਹਨੂੰ ਸਲੋਅ ਗੈਸ 'ਤੇ ਰੱਖ ਲੈਂਦੇ ਹਾਂ ਅਤੇ ਜਿਹੜਾ ਪਕਵਾਨ ਮੈਂ ਕਹਿ ਸਕਦੀ ਹਾਂ ਸੌਖਾ ਹੈ ਬਣਾਉਣਾ ਉਹ ਮੈਨੂੰ ਸੁੱਕੇ ਆਲੂ ਲੱਗਦੇ ਹੈ ਜਿਹਦੇ ਵਿੱਚ ਆਪਾਂ ਘਿਓ ਪਾ ਕੇ ਜੀਰਾ ਤੜਕ ਕੇ ਜੇ ਆਪਣੇ ਸਵਾਦ ਅਨੁਸਾਰ ਟਮਾਟਰ ਪਾਉਣਾ ਤਾਂ ਟਮਾਟਰ ਪਾ ਕੇ ਸਾਨੂੰ ਵਧੀਆ ਲੱਗਦੇ ਹੈ ਅਸੀਂ ਟਮਾਟਰ ਵੀ ਪਾ ਲੈਂਦੇ ਹਾਂ ਤਾਂ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਉਹ ਸੁੱਕੇ ਆਲੂ ਜਦੋਂ ਜੀਰਾ ਤੜਕ ਕੇ ਆਪਾਂ ਟਮਾਟਰ ਵਿੱਚ ਪਾ ਕੇ ਹਰੀ ਮਿਰਚ ਪਾ ਕੇ ਆਲੂ ਆਪਾਂ ਗੋਲ ਸ਼ੇਪ ਵਿੱਚ ਕੱਟ ਕੇ ਪਾ ਦਿੰਦੇ ਹਾਂ ਤਾਂ ਤਾਂ ਮੈਨੂੰ ਉਹਨੂੰ ਬਣਾਉਣ ਦੇ ਵਿੱਚ ਹਾਡਲੀ ਪੰਦਰਾਂ ਕੁ ਮਿੰਟ ਲੱਗਦੇ ਨੇ ਕਾਫੀ ਜ਼ਿਆਦਾ ਸਵਾਦ ਅਤੇ ਉਹ ਕ੍ਰਿਸਪੀ ਅਗਰ ਪਾਣੀ ਨਾਲ ਅਸੀਂ ਰਝਾ ਲਈਏ ਜੇ ਉਹਨੂੰ ਜ਼ਿਆਦਾ ਜਲਦੀ ਰਝਾਉਣਾ ਨਾ ਦਸ ਮਿੰਟ ਦੇ ਵਿੱਚ ਜਾਂ ਬਾਰਾਂ ਕੁ ਮਿੰਟ ਦੇ ਵਿੱਚ ਰਝਾਉਣਾ ਹੈਗਾ ਤਾਂ ਉਹ ਫਟਾਫਟ ਬਣਾਉਣਾ ਹੋਵੇ ਜਿਵੇਂ ਕੋਈ ਆ ਜੇ ਤਾਂ ਉਹਨੂੰ ਆਲੂ ਨਾਲ ਰੋਟੀ ਖਵਾਉਣੀ ਹੋਵੇ ਤਾਂ ਬਾਰਾਂ ਕੁ ਮਿੰਟ ਲੱਗਦੇ ਹੈ ਪਾਣੀ ਨਾਲ ਪਕਾਉਣਾ ਹੋਵੇ ਜੇ ਅਤੇ ਜੇ ਉਹਨਾਂ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਉਣਾ ਵੀ ਆਪਾਂ ਚਾਹੁੰਦੇ ਹਾਂ ਕ੍ਰਿਸਪੀ ਹੋਣ ਤਾਂ ਉਹ ਫਿਰ ਉਹਨੂੰ ਬਿਨਾਂ ਉਸ ਤੋਂ ਪਾਣੀ ਤੋਂ ਪਕਾ ਦਿੰਦੇ ਹੈਗੇ ਅਸੀਂ ਅਤੇ ਉਹਨੂੰ ਬਿਨਾਂ ਪਾਣੀ ਤੋਂ ਵਧੀਆਂ ਤਰ੍ਹਾਂ ਪੱਕ ਜਾਂਦੇ ਨੇ ਅਤੇ ਜੇ ਮੈਂ ਔਖੇ ਪਕਵਾਨ ਦੀ ਗੱਲ ਕਰਾਂ ਤਾਂ ਉਹ ਸਭ ਤੋਂ ਜ਼ਿਆਦਾ ਔਖੇ ਰਾਜਮਾਂਹ ਬਣਾਉਣੇ ਹੈ ਕਿਉਂਕਿ ਉਹਨੂੰ ਪਹਿਲੇ ਸੱਤ ਅੱਠ ਸੀਟੀਆਂ ਨਾਲ ਸੱਤ ਅੱਠ ਨਹੀਂ ਚਲੋ ਪੰਜ ਛੇ ਨਾਲ ਪਹਿਲੇ ਉਸਨੂੰ ਥੋੜ੍ਹਾ ਬੋਇਲ ਕਰਨਾ ਪੈਂਦਾ ਇਕੱਲੀ ਰਾਜਮਾਂਹ ਨੂੰ ਫਿਰ ਤੜਕਾ ਕੱਟੋ ਉਹਦੇ ਵਿੱਚ ਤੜਕਾ ਵੀ ਜ਼ਿਆਦਾ ਪੈਂਦਾ ਅਤੇ ਫਿਰ ਉਹਦੇ ਤੜਕੇ ਨੂੰ ਭੁੰਨੋ ਪਹਿਲੇ ਚੰਗੀ ਤਰ੍ਹਾਂ ਫਿਰ ਉਹਦੇ ਰਾਜਮਾਂਹ ਪਾ ਕੇ ਫਿਰ ਦੁਬਾਰਾ ਉਹ ਦੋਨਾਂ ਨੂੰ ਮਿਕਸ ਕਰਨ ਵਾਸਤੇ ਜ਼ਿਆਦਾ ਸੀਟੀਆਂ ਵਜਾਓ ਅਤੇ ਜਿਹੜੇ ਜਿਹੜੇ ਮੈਂ ਪਕਵਾਨ ਪਕਾਉਂਦੀ ਹਾਂ ਉਹਦੇ 'ਚੋਂ ਸਭ ਤੋਂ ਸੌਖਾ ਮੈਨੂੰ ਸੁੱਕੇ ਆਲੂ ਅਤੇ ਔਖਾ ਰਾਜਮਾਂਹ ਦੀ ਸਬਜ਼ੀ ਤਰੀ ਵਾਲੀ ਕੋਈ ਵੀ ਸਬਜ਼ੀ ਉਹਦੇ 'ਚ ਉਹਦਾ ਚੱਕਰ ਇਹ ਹੈ ਵੀ ਉਹਨੂੰ ਉਹਦੀ ਤਰੀ ਨੂੰ ਗਾੜਾ ਅਤੇ ਵਧੀਆ ਬਣਾਉਣ ਲਈ ਜਿਹੜੀ ਉਹਦੇ ਵਿੱਚ ਪਿਆਜ਼ ਪੈਂਦੇ ਨੇ ਉਹ ਜ਼ਿਆਦਾ ਪੈਂਦੇ ਨੇ ਅਤੇ ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਜਾਂ ਦੁਪਹਿਰ ਵੇਲੇ ਸਬਜ਼ੀ ਖ਼ਤਮ ਹੋ ਜੇ ਤਾਂ ਰਾਤ ਨੂੰ ਅਸੀਂ ਸੁੱਕੇ ਆਲੂ ਬਣਾ ਲੈਂਦੇ ਹੁੰਦੇ ਹਾਂ ਅਤੇ ਜਦੋਂ ਕਿਸੇ ਮਹਿਮਾਨ ਨੇ ਆਉਣਾ ਵਧੀਆ ਸਬਜ਼ੀ ਬਣਾਉਣੀ ਹੈ ਰਾਜਮਾਂਹ ਚਿੱਟੇ ਛੋਲੇ ਕਾਲੇ ਛੋਲੇ ਇਹ ਪਕਵਾਨ ਬਣਾਏ ਜਾਂਦੇ ਨੇ ਅਤੇ ਚਿਲੀ ਪਨੀਰ ਮਸ਼ਰੂਮ ਚਿਲੀ ਇਹ ਸਭ ਪਕਵਾਨਾਂ ਨੂੰ ਪਕਵਾਨ ਵੀ ਆਪਣਾ ਆਪਣਾ ਸਮਾਂ ਲੈ ਕੇ ਪੱਕਦੇ ਨੇ ਅਤੇ ਇਹ ਥੋੜ੍ਹੇ ਜਿਹੇ ਫੈਂਸੀ ਡਿਸ਼ ਵਿੱਚ ਆ ਜਾਂਦੇ ਨੇ ਫੈਂਸੀ ਡਿਸ਼ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ ਅਤੇ ਇਹ ਮੇਰਾ ਜਿਹੜਾ ਹੈਗਾ ਅਨੁਭਵ ਹੈ ਉਹ ਇਹ ਹੀ ਬਿਆਨ ਕਰਦਾ ਵੀ ਹਰ ਇੱਕ ਪਕਵਾਨ ਆਪਣੇ ਹਿਸਾਬ ਨਾਲ ਪੱਕਦਾ ਹੈ ਅਤੇ ਕੁਛ ਪਕਵਾਨ ਸੌਖੇ ਅਤੇ ਕੁਛ ਪਕਾਵਾਨ ਔਖੇ ਹੁੰਦੇ ਹਨ ਜੋ ਕਿ ਸਮੇਂ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ ਮੌਸਮ ਦੇ ਹਿਸਾਬ ਨਾਲ ਵੀ ਬਣਾਏ ਜਾਂਦੇ ਹਨ ਅਤੇ ਕਿਸੇ ਈਵੈਂਟ ਦੇ ਹਿਸਾਬ ਨਾਲ ਵੀ ਬਣਾਏ ਜਾਂਦੇ ਹਨ ਧੰਨਵਾਦ ਜੀ